ਬਦਲਦੇ ਮੌਸਮ ਦਾ ਸਾਡੇ ਖੇਤਰ ਦੀ ਖੇਤੀ 'ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਹੜ੍ਹਾਂ ਹੜ੍ਹ ਗੜੇ ਮਾਰੀ ਅਤੇ ਸੋਕਾ ਖੇਤੀ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਮੌਸਮ ਦਾ ਖੇਤੀਬਾੜੀ ਨਾਲ ਗੂੜਾ ਸੰਬੰਧ ਹੈ ਫਸਲ ਦੇ ਹਰ ਪੜਾਅ 'ਤੇ ਮੌਸਮੀ ਤਬਦੀਲੀਆਂ ਦਾ ਅਸਰ ਦੇਖਣ ਨੂੰ ਮਿਲਦਾ ਹੈ ਜਲਵਾਯੂ ਬਦਲ ਕਾਰਣ ਮੌਸਮ ਤਬਦੀਲੀ ਵੀ ਵੱਧ ਰਹੀ ਹੈ ਖੇਤੀ ਗਿ ਵਿਗਿਆਨੀ ਦਿਨ ਬ ਦਿਨ ਦੀਆਂ ਕਈ ਨਵੀਆਂ ਤਕਨੀਕਾਂ ਦਾ ਵਿਕਾਸ ਕਰ ਰਹੇ ਹਨ ਪਰ ਮੌਸਮੀ ਖਲਬਲੀਆਂ ਕਾਰਣ ਸਫਲਤਾ ਦੀ ਰਫਤਾਰ ਧੀਮੀ ਗਤੀ ਨਾਲ ਚੱਲ ਰਹੀ ਹੈ ਦੁਨੀਆ ਭਰ ਚ ਫੈਲੀ ਕਰੋਨਾ ਮਹਾਂਮਾਰੀ ਨੇ ਪੂਰੀ ਮਨੁੱਖਤਾ ਨੂੰ ਕਈ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ਇਸ ਬਿਮਾਰੀ ਸਦਕਾ ਜਿੱਥੇ ਕਿ ਸਾਰਾ ਜਨਜੀਵਨ ਪ੍ਰਭਾਵਿਤ ਹੋਇਆ ਉੱਥੇ ਕਿਸਾਨਾਂ ਨੂੰ ਖੇਤੀ ਸਬੰਧੀ ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਇਸ ਤੋਂ ਇਹ ਸਿੱਧ ਹੋ ਗਿਆ ਹੈ ਕਿ ਅੱਜ ਦੇ ਇਸ ਡਿਜੀਟਲ ਯੁੱਗ 'ਚ ਇਲੈਕਟਰੋਨਿਕ ਪ੍ਰਸਾਰ ਸਾਧਨਾ ਦੀ ਬਹੁਤ ਮਹੱਤਵਤਾ ਹੈ ਕਿਸਾਨਾਂ ਦੀ ਸਹੂਲਤ ਲਈ ਸਰਕਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀਆਂ ਵੱਲੋਂ ਵੀ ਸਮੇਂ ਸਮੇਂ 'ਤੇ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਤਾਂ ਕਿ ਕਿਸਾਨਾਂ ਦਾ ਹਰ ਕਿਸਾਨਾਂ ਤੱਕ ਹਰ ਜਾਣਕਾਰੀ ਜਲਦੀ ਤੋਂ ਜਲਦੀ ਪਹੁੰਚਦੀ ਕੀਤੀ ਜਾਵੇ ਪੰਜਾਬ ਖੇਤੀਬਾੜੀ ਯੂਨੀਵਰਸਿਟੀਆਂ ਵੱਲੋਂ ਲਗਾਤਾਰ ਹੋ ਰਹੀਆਂ ਮੌਸਮੀ ਤਬਦੀਲੀਆਂ ਨੂੰ ਘੋ ਘੋਖਣ 'ਤੇ ਫਸਲਾਂ ਉੱਪਰ ਇਸ ਦੇ ਅਸਰ ਨੂੰ ਪੜਚੋਲਣ ਲਈ ਕੇਂਦਰ ਸਰਕਾਰ ਦਾ ਮੌਸਮੀ ਵਿਗਿਆਨ ਵਿਭਾਗ ਤੋਂ ਪ੍ਰਾਪਤ ਮੌਸਮ ਦੀ ਆਗੂਆਂ ਜਾਣਕਾਰੀ ਅਤੇ ਮੌਸਮੀ ਸਲਾਹ ਸੇਵਾਵਾਂ ਕਿਸਾਨਾਂ ਤੱਕ ਵੱਖ ਵੱਖ ਮਾਧਿਅਮਾਂ ਰਾਹੀਂ ਪਹੁੰਚਾਈਆਂ ਜਾਂਦੀਆਂ ਹਨ ਕਿਸਾਨਾਂ ਵੱਲੋਂ ਤਕਨੀ ਤਕਨੀਕੀ ਤਕਨੀਕ ਦੀ ਸਹਾਇਤਾ ਨਾਲ ਮੌਸਮ ਦੀ ਭਵਿੱਖਬਾਣੀ ਜਾਣ ਕੇ ਫਸਲਾਂ ਦੀ ਕਟਾਈ ਜਲਦ ਜਾਂ ਲੇਟ ਕੀਤੀ ਜਾਂਦੀ ਹੈ ਪਰੰਤੂ ਮੰਡੀ ਵਿੱਚ ਵੀ ਬਹੁਤ ਵੀ ਬਹੁਤੀਆਂ ਸਫਲਤਾ ਦਾ ਪ੍ਰਬੰਧ ਨਾ ਹੋਣ ਕਾਰਣ ਫਸਲ ਖਰਾਬ ਹੋ ਜਾਂਦੀ ਹੈ